ਇੱਕ ਵਾਰੀ ਮੈਂ ਇੱਕ ਫੋਟੋਗ੍ਰਾਫੀ ਦੀ ਵਰਕਸ਼ਾਪ ਵਿੱਚ ਹਿੱਸਾ ਲਿਤਾ ਸੀਗਾ ਅਤੇ ਉੱਥੇ ਉਹਨਾਂ ਨੇ ਫੋਟੋਗ੍ਰਾਫੀ ਦੀ ਤਕਨੀਕਾਂ ਬਾਰੇ ਬਹੁਤ ਕੁਝ ਦੱਸਿਆ ਜਿਵੇਂ ਅਸੀਂ ਸੱਜੇ ਪਾਸੋਂ ਕਿਵੇਂ ਫੋਟੋ ਖਿੱਚ ਸਕਦੇ ਹਨ ਅਤੇ ਖੱਬਿਓ ਪਾਸੇ ਕਿਵੇਂ ਫੋਟੋ ਖਿੱਚ ਸਕਦੇ ਹਨ ਕਿਹੜੇ ਐਂਗਲ 'ਤੇ ਜਿਹੜੀ ਫੋਟੋਗ੍ਰਾਫੀ ਹੈ ਉਹ ਜ਼ਿਆਦਾ ਵਧੀਆ ਆ ਸਕਦੀ ਹੈ ਇਹ ਜਿਹੜਾ ਹੈਗਾ ਉਹ ਪਿੱਛੇ ਸਨੈਰੀਓ ਜਿਹੜਾ ਵੀ ਸੀਨਰੀ ਹੋਵੇ ਉਹਦੇ ਉੱਤੇ ਵੀ ਡਿਪੈਂਡ ਕਰਦਾ ਹੈ ਅਤੇ ਅਸੀਂ ਇਹ ਵੀ ਉਸ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਕਿ ਅਸੀਂ ਪੂਰੀ ਸਿੰਨਰੀ ਨੂੰ ਫੋਕਸ ਕਰਨਾ ਹੈ ਜਾਂ ਫਿਰ ਅਸੀਂ ਕਿਸੇ ਇੱਕ ਬੰਦੇ ਨੂੰ ਫੋਕਸ ਕਰਨਾ ਹੈ ਜੇ ਬਹੁਤ ਸਾਰੇ ਬੰਦਿਆਂ ਦੀ ਫੋਟੋ ਇੱਕੋ ਸਾਹ ਫੋਟੋਗ੍ਰਾਫੀ ਇੱਕੋ ਇੱਕੋ ਸਾਹ ਖਿੱਚਣੀ ਹੈ ਜੇ ਇੱਕ ਇੱਕ ਹੀ ਫੋਟੋ ਵਿੱਚ ਸਾਰੇ ਬੰਦਿਆਂ ਨੂੰ ਕੈਪਚਰ ਕਰਨਾ ਹੈਗਾ ਤਾਂ ਅਸੀਂ ਕਿਸ ਐਂਗਲ ਤੋਂ ਫੋਟੋ ਖਿੱਚਣੀ ਹੈ ਜੇ ਕਿਸੇ ਇੱਕ ਬੰਦੇ ਦੀ ਫੋਟੋ ਅਸੀਂ ਖਿੱਚਣੀ ਹੈ ਅਤੇ ਕਿਵੇਂ ਉਸ ਬੰਦੇ ਦੀ ਅਸੀਂ ਨਜ਼ਦੀਕਿਓਂ ਫੋਟੋ ਖਿੱਚ ਸਕਦੇ ਹਾਂ ਅਸੀਂ ਉਹ ਉਹਦੀ ਫੋਟੋ ਥੋੜ੍ਹੀ ਜਿਹੀ ਦੂਰੋਂ ਖਿੱਚ ਸਕਦੇ ਹਾਂ ਅਤੇ ਅਸੀਂ ਉਹਦੀ ਫੋਟੋ ਥੋੜ੍ਹੀ ਜਿਹੀ ਹੋਰ ਦੂਰੋਂ ਜਾਂ ਸੱਜਿਓ ਪਾਸੋਂ ਜਾਂ ਖੱਬਿਓ ਪਾਸੇ ਵੀ ਖਿੱਚ ਸਕਦੇ ਹਾਂ ਜੇ ਅਸੀਂ ਕਿਸੇ ਪਰਟੀਕੁਲਰ ਓਬਜੈਕਟ ਜਾਂ ਕਿਸੇ ਵਿਸ਼ੇਸ਼ ਚੀਜ਼ ਉੱਤੇ ਫੋਕਸ ਕਰਨਾ ਹੈ ਜਿਹੜੀ ਉਸ ਬੰਦੇ ਨੇ ਪਾਈ ਹੋਈ ਹੈ ਅਤੇ ਅਸੀਂ ਆਪਣੇ ਕੈਮਰੇ ਦਾ ਜਿਹੜਾ ਐਂਗਲ ਹੈ ਉਹ ਉੱਚਾ ਅਤੇ ਨੀਵਾਂ ਹੋਰ ਕਰਕੇ ਚੇਂਜ ਕਰ ਸਕਦੇ ਹਾਂ ਅੱਜ ਕਰ ਫੋਟੋਗ੍ਰਾਫੀ ਦੀ ਤਕਨੀਕਾਂ ਵਿੱਚ ਹੋਰ ਵੀ ਕਈ ਤਰੀਕੇ ਦੀਆਂ ਚੀਜ਼ਾਂ ਸਿਖਾਈ ਜਾਂਦੀਆਂ ਹਨ ਜਿਵੇਂ ਕਿ ਕੈਮਰਾ ਲੈਂਸ ਦੇ ਅੱਗੇ ਜੇ ਅਸੀਂ ਕੋਈ ਚੀਜ਼ ਰੱਖ ਦੀਏ ਜਿਵੇਂ ਕਿ ਟਰਾਂਸਪੇਰੈਂਟ ਪੇਪਰ ਰੱਖ ਦਈਏ ਅਤੇ ਫੋਟੋ ਖਿੱਚਣ ਦਾ ਜਿਹੜਾ ਨਜ਼ਾਰਾ ਹੈ ਉਹ ਚੇਂਜ ਹੋ ਜਾਂਦਾ ਹੈ ਅਸੀਂ ਫੋਟੋ ਖਿੱਚਦੇ ਜਿਹੜੀ ਹੈ ਬੰਦੇ ਦੀ ਸਾਹਮਣੇ ਖੜ੍ਹੇ ਦੀ ਅਤੇ ਉਹਦੀ ਜਿਹੜੀ ਫੋਟੋ ਬਣੇਗੀ ਉਹਦੇ ਵਿੱਚ ਸਾਨਾ ਸਾਨੂੰ ਜਿਹੜਾ ਫੋਟੋ ਦਿਖੇਗੀ ਉਹ ਡਿਫਰੈਂਟ ਹੋਵੇਗੀ ਇਸੇ ਤਰੀਕੇ ਨਾਲ ਜੇ ਅਸੀਂ ਲੈਂਸ ਦੇ ਅੱਗੇ ਉਹਨੂੰ ਅੱਧਾ ਅੱਧਾ ਹਿੱਸਾ ਉਹਦਾ ਕਵਰ ਕਰ ਦੀਏ ਅਤੇ ਅੱਧਾ ਹਿੱਸਾ ਖੁੱਲ੍ਹਾ ਛੱਡ ਦੀਏ ਅਤੇ ਉਹ ਫੋਟੋ ਖਿੱਚਣ ਨਾਲ ਸਾਨੂੰ ਫੋਟੋ ਦੀ ਜਿਹੜੀ ਪਿਕਚਰ ਦਿਖਾਈ ਦੇਗੀ ਉਹ ਥੋੜ੍ਹੀ ਜਿਹੀ ਡਿਫਰੈਂਟ ਹੋਏਗੀ ਸੋ ਅੱਜ ਕੱਲ੍ਹ ਫੋਟੋਗ੍ਰਾਫੀ ਕਰਨ ਦੀਆਂ ਬਹੁਤ ਸਾਰੀ ਤਰੀਕਿਆਂ ਹਨ